ਸਾਡੇ ਸਥਾਨ ਦੇ ਨੇੜੇ ਹੀ ਇੱਕ ਸ਼ਹਿਰ ਅੰਮ੍ਰਿਤਸਰ ਨਾਮ ਦਾ ਸ਼ਹਿਰ ਇੱਕ ਸਥਿਤ ਹੈ ਜਿਹੜਾ ਕਿ ਬਹੁਤ ਹੀ ਜ਼ਿਆਦਾ ਪ੍ਰਸਿੱਧ ਹੈ ਇਹ ਸ਼ਹਿਰ ਦੇ ਵਿੱਚ ਘੁੰਮਣ ਯੋਗ ਸ ਜਗਾਵਾਂ ਵੀ ਬਹੁਤ ਹਨ ਅਤੇ ਬਹੁਤ ਪੁਰਾਣੀਆਂ ਇਮਾਰਤਾਂ ਵੀ ਇਹਦੇ ਵਿੱਚ ਸਥਿਤ ਨੇ ਜਿੱਦਾਂ ਕਿ ਅੰਮ੍ਰਿਤਸਰ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਹੈ ਹਰਿਮੰਦਰ ਸਾਹਿਬ ਜਿਹੜਾ ਕਿ ਬਹੁਤ ਹੀ ਜ਼ਿਆਦਾ ਪ੍ਰਸਿੱਧ ਹੈ ਅਤੇ ਪ੍ਰਚਲਿਤ ਹੈ ਅਤੇ ਇਸ ਦੇ ਬਹੁਤ ਹੀ ਜ਼ਿਆਦਾ ਵੱਡਾ ਇਤਿਹਾਸ ਵੀ ਹੈ ਅੰਮ੍ਰਿਤਸਰ ਦੇ ਅੰਦਰ ਇੱਕ ਜਲ੍ਹਿਆਂ ਵਾਲੇ ਬਾਗ ਦੇ ਨਾਮ ਦੇ ਉੱਤੇ ਜਗ੍ਹਾ ਬਣਾਈ ਗਈ ਹੋਈ ਆ ਇਸ ਜਗ੍ਹਾ ਦੇ ਵਿੱਚ ਜਨਰਲ ਡਾਇਰ ਨੇ ਕਿੰਨੇ ਹੀ ਮਜ਼ਲੂਮਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀਗਾ ਅਤੇ ਉੱਥੇ ਹੀ ਇੱਕ ਸਮਾਰਕ ਵੀ ਬਣਾਈ ਗਈ ਹੈ ਉਹਨਾਂ ਸ਼ਹੀਦਾਂ ਦੇ ਨਾਮ 'ਤੇ ਜਿਸ ਨੂੰ ਜਲ੍ਹਿਆਂਵਾਲਾ ਬਾਗ ਕਿਹਾ ਜਾਂਦਾ ਆ ਹੋਰ ਵੀ ਕਈ ਜਗਾਵਾਂ ਨੇ ਅੰਮ੍ਰਿਤਸਰ ਦੇ ਵਿੱਚ ਜੋ ਕਿ ਘੁੰਮਣਯੋਗ ਹਨ ਜਿਵੇਂ ਕਿ ਘੰਟਾ ਘਰ ਹੋ ਗਿਆ ਅਤੇ ਆਪਣਾ ਵਾਹਗਾ ਬਾਡਰ ਜੋ ਕਿ ਅੰਮ੍ਰਿਤਸਰ ਦੇ ਨੇੜੇ ਹੀ ਹੈ ਅਤੇ ਹੋਰ ਵੀ ਕਈ ਤਰ੍ਹਾਂ ਦੇ ਪਾਰਕ ਨੇ ਜਿਨ੍ਹਾਂ ਦੇ ਵਿੱਚ ਕਈ ਤਰ੍ਹਾਂ ਦਾ ਸੱਭਿਆਚਾਰ ਵੀ ਦੱਸਿਆ ਜਾਂਦਾ ਹੈ ਅੰਮ੍ਰਿਤਸਰ ਦੇ ਸ਼ਹਿਰਾਂ ਦੇ ਵਿੱਚ ਮਾਰਕੀਟ ਦੇ ਵਿੱਚ ਸੱਭਿਆਚਾਰ ਨੂੰ ਦੀ ਝਲਕ ਦੇਖੀ ਜਾਂਦੀ ਹੈ ਸੱਭਿਆਚਾਰ ਦੀ ਝਲਕ ਜਾਣੀ ਕਿ ਪੁਰਾਣੇ ਰਵਾਇਤੀ ਚੀਜ਼ਾਂ ਔਰਤਾਂ ਦੇ ਲਈ ਗਹਿਣੇ ਆਰਟੀਫਿਸ਼ਅਲ ਗਹਿਣੇ ਜੁੱਤੀਆਂ ਪਰਾਂਦੇ ਡੋਰੀਆਂ ਫੁਲਕਾਰੀਆਂ ਪੰਜਾਬੀ ਕਢਾਈ ਦੇ ਸੂਟ ਮਰਦਾਂ ਦੇ ਲਈ ਵੀ ਪੱਗਾਂ ਅਤੇ ਹੋਰ ਵੀ ਕਈ ਤਰ੍ਹਾਂ ਦੇ ਕੱਪੜੇ ਜੁੱਤੀਆਂ ਕੈਂਠੇ ਮਿਲ ਜਾਂਦੇ ਹਨ ਅੰਮ੍ਰਿਤਸਰ ਆਪਣੇ ਹੀ ਆਪ ਵਿੱਚ ਇੱਕ ਖਾਸ ਹੈ ਅੰਮ੍ਰਿਤਸਰ ਦੇ ਵਿੱਚ ਸਮਾਰਕਾਂ ਅਤੇ ਭੋਜਨ ਦੇ ਨਾਮ 'ਤੇ ਵੀ ਅੰਮ੍ਰਿਤਸਰ ਬਹੁਤ ਜ਼ਿਆਦਾ ਪ੍ਰਸਿੱਧ ਹੈ ਸਰਸੋਂ ਦਾ ਸਾਗ ਮੱਕੀ ਦੀ ਰੋਟੀ ਦੇਸੀ ਘਿਉ ਅਤੇ ਲੱਸੀ ਇਹ ਚੀਜ਼ਾਂ ਬਿਲਕੁਲ ਖਾਸ ਸਥਾਨ ਜਿਹੜਾ ਰੱਖਦੀਆਂ ਨੇ ਅੰਮ੍ਰਿਤਸਰ ਦੇ ਅੰਦਰ